ਹਾਂਜੀ ਖਾਣਾ ਬਣਾਉਣਾ ਮੈਨੂੰ ਬਹੁਤ ਪਸੰਦ ਹੈ ਅਤੇ ਅੱਜ ਦੇ ਸਮੇਂ ਦੇ ਵਿੱਚ ਮੈਂ ਕਿਚਨ ਦੇ ਵਿੱਚ ਵੱਧ ਤੋਂ ਵੱਧ ਸਮਾਂ ਬਿਤਾਉਣਾ ਪਸੰਦ ਕਰਦੀ ਹਾਂ ਅਤੇ ਮੈਂ ਤਰ੍ਹਾਂ ਤਰ੍ਹਾਂ ਦੇ ਖਾਣ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਬਣਾਉਂਦੀ ਰਹਿੰਦੀ ਹਾਂ ਨਵੇਂ ਨਵੇਂ ਐਕਸਪੀਰੀਅੰਸ ਕਰਦੀ ਰਹਿੰਦੀ ਹਾਂ ਪਰ ਇੱਕ ਸਮਾਂ ਅਜਿਹਾ ਸੀ ਜਦੋਂ ਛੋਟੇ ਸੀ ਤਾਂ ਮਤਲਬ ਜਦੋਂ ਮਾਂ ਦੇ ਹੱਥ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਖਾਧੀਆਂ ਜਾਂਦੀਆਂ ਸਨ ਜਿਵੇਂ ਕੜਾਹ ਜਿਸਨੂੰ ਹਲਵਾ ਵੀ ਬੋਲਿਆ ਜਾਂਦਾ ਮੈਨੂੰ ਖਾਣਾ ਬਹੁਤ ਪਸੰਦ ਸੀ ਪਰ ਮੈਨੂੰ ਇਹ ਬਿਲਕੁਲ ਨਹੀਂ ਸੀ ਪਤਾ ਕਿ ਇਹ ਕਿਵੇਂ ਬਣਦਾ ਇਹਦੇ 'ਚ ਕਿਹੜੀਆਂ ਕਿਹੜੀਆਂ ਚੀਜ਼ਾਂ ਪੈਦੀਆਂ ਨੇ ਅਤੇ ਇੱਕ ਵਾਰੀ ਮੈਂ ਆਪਣੀ ਮੰਮੀ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਸੋਚਿਆ ਕਿ ਵੀ ਮੇਰਾ ਹੁਣ ਕੜਾਹ ਖਾਣ ਨੂੰ ਦਿਲ ਕਰ ਰਿਹਾ ਹਲਵਾ ਖਾਣ ਨੂੰ ਤਾਂ ਮੈਂ ਉਸ ਨੂੰ ਖੁਦ ਬਣਾ ਲੈਂਦੀ ਹਾਂ ਤਾਂ ਮੈਂ ਅੰਦਾਜ਼ਨ ਹੀ ਮਤਲਬ ਜਿਸ ਤਰ੍ਹਾਂ ਕੜਾਹੀ ਦੇ ਵਿੱਚ ਆਟਾ ਭੁੰਨਣ ਲੱਗ ਗਈ ਅਤੇ ਮੈਨੂੰ ਇਹ ਵੀ ਨਹੀਂ ਸੀ ਪਤਾ ਉਸ ਆਟੇ ਨੂੰ ਕਿੰਨਾ ਲਾਲ ਕਰਨਾ ਹੁੰਦਾ ਕਿੰਨੀ ਦੇਰ ਭੁੰਨਣਾ ਹੁੰਦਾ ਉਹਦੇ 'ਚ ਕਿੰਨਾ ਪਾਣੀ ਪਾਉਣਾ ਕਿੰਨੀ ਚੀਨੀ ਪਾਉਣੀ ਹੈ ਤਾਂ ਮੈਂ ਬੱਸ ਅੰਦਾਜ਼ੇ ਦੇ ਨਾਲ ਹੀ ਉਸਨੂੰ ਭੁੰਨ ਲਿਆ ਉਹਦੇ 'ਚ ਪਾਣੀ ਪਾ ਦਿੱਤਾ ਅਤੇ ਉਹਦੇ 'ਚ ਚੀਨੀ ਪਾ ਦਿੱਤੀ ਉਹ ਓਨਾ ਸਵਾਦ ਤਾਂ ਨਹੀਂ ਬਣਿਆ ਜਿੰਨਾ ਸਵਾਦ ਮੇਰੀ ਮੰਮੀ ਬਣਾਉਂਦੀ ਹੁੰਦੀ ਸੀ ਪਰ ਉਹ ਮੇਰਾ ਫਸਟ ਐਕਸਪੀਰੀਅੰਸ ਸੀ ਬਿਨਾਂ ਜਾਣੇ ਬੁੱਝੇ ਮੈਂ ਕੜਾਹ ਹਲਵਾ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਥੋੜ੍ਹਾ ਜਿਹਾ ਮਤਲਬ ਜ਼ਿਆਦਾ ਆਟਾ ਭੁੰਨਿਆ ਵੀ ਨਹੀਂ ਗਿਆ ਹੈਗਾ ਹਲਕਾ ਜਿਹਾ ਕੱਚਾ ਰਹਿ ਗਿਆ ਅਤੇ ਕੱਚਾ ਆਟਾ ਹਮੇਸ਼ਾ ਤਾਲੂ ਦੇ ਨਾਲ ਲੱਗਦਾ ਹੁੰਦਾ ਜਦੋਂ ਖਾਂਦੇ ਹਾਂ ਤਾਂ ਇਹ ਮੇਰਾ ਪਹਿਲਾ ਐਕਸਪੀਰੀਅੰਸ ਸੀ ਤਾਂ ਉਸ ਤੋਂ ਬਾਅਦ ਫੇਰ ਮੈਨੂੰ ਸਮਝ ਆ ਗਈ ਕਿ ਆਟੇ ਨੂੰ ਜਿੰਨਾ ਜ਼ਿਆਦਾ ਭੁੰਨਿਆ ਜਾਵੇਗਾ ਹਲਵਾ ਓਨਾ ਹੀ ਲਾਲ ਰੰਗ ਦੇ ਵਿੱਚ ਬਣੇਗਾ ਅਤੇ ਸਵਾਦ ਬਣੇਗਾ